ਸਭ ਤੋਂ ਜ਼ਿਆਦਾ ਜੋ ਪਰਿਵਾਰਿਕ ਪਕਵਾਨ ਜੋ ਮਤਲਬ ਪੀੜੀਆਂ ਤੋਂ ਚੱਲਦਾ ਆ ਰਿਹਾ ਉਹ ਮੇਰੇ ਮੰਮੀ ਦੇ ਹੱਥ ਦੀਆਂ ਪਿੰਨੀਆਂ ਹੈ ਜੋ ਕਿ ਮੈਨੂੰ ਵੀ ਮੈਂ ਵੀ ਕਾਫ਼ੀ ਅੱਛੀਆਂ ਬਣਾ ਲੈਂਦੀ ਹਾਂ